ਪਟਿਆਲਾ ਸ਼ਹਿਰ ਮੇਰਾ ਜੱਦੀ ਸ਼ਹਿਰ ਹੈ ਇਸ ਵਿੱਚ ਮੈਂ ਬਹੁਤ ਹੀ ਵਧੀਆ ਤਰ੍ਹਾਂ ਪਟਿਆਲੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਿਆਨ ਕਰ ਸਕਦੀ ਹਾਂ ਜਿਵੇਂ ਕਿ ਮੇਰੀਆਂ ਮਨਪਸੰਦ ਚੀਜ਼ਾਂ ਪਟਿਆਲਾ ਸ਼ਹਿਰ ਵਿੱਚ ਗੁਰਦੁਆਰਾ ਕਿਲ੍ਹਾ ਚੌਂਕ ਮੰਦਿਰ ਬਾਰਾਦਰੀ ਗਾਰਡਨ ਰੈਸਟੋਰੈਂਟਸ ਪਟਿਆਲਾ ਸੂਟਸ ਜੁੱਤੀ ਅਤੇ ਜਿਵੇਂ ਕਿ ਮੈਂ ਪਟਿਆਲੇ ਵਿੱਚ ਗੁਰਦੁਆਰੇ ਆਉਂਦੀ ਜਾਂਦੀ ਰਹਿੰਦੀ ਹਾਂ ਜਿੱਥੇ ਜੋ ਕਿ ਗੁਰਦੁਆਰਾ ਦੂਖਨਿਵਾਰਨ ਸਾਹਿਬ ਹੈ ਇੱਥੇ ਨੌਵੇਂ ਪਾਤਸ਼ਾਹ ਜੀਆਂ ਨੂੰ ਚਰਨ ਛੋਹ ਪ੍ਰਾਪਤ ਗੁਰਦੁਆਰਾ ਹੈ ਅਤੇ ਮੈਂ ਕਿਲ੍ਹਾ ਚੌਂਕ ਵੀ ਜਾਂਦੀ ਕਿਲ੍ਹਾ ਮੁਬਾਰਕ ਵੀ ਜਾਂਦੀ ਰਹਿੰਦੀ ਹਾਂ ਜਿੱਥੇ ਬਹੁਤ ਹੀ ਵੱਡਾ ਕਿਲ੍ਹਾ ਬਣਿਆ ਹੋਇਆ ਹੈ ਉਸ ਵਿੱਚ ਅੰਦਰ ਕਾਫੀ ਸਾਰੇ ਹਥਿਆਰ ਜੋ ਕਿ ਰਾਜੇ ਮਹਾਰਾਜਿਆਂ ਦੇ ਪਏ ਹਨ ਅਤੇ ਉੱਥੇ ਇੱਕ ਚਾਂਦੀ ਦੀ ਬੱਗੀ ਵੀ ਹੈ ਅਤੇ ਮੈਂ ਮੰਦਰ ਵੀ ਜਾਂਦੀ ਰਹਿੰਦੀ ਹਾਂ ਕਿ ਅ ਕਾਲੀ ਮਾਤਾ ਮੰਦਰ ਆ ਜੋ ਕਿ ਪਟਿਆਲੇ ਵਿੱਚ ਉਹ ਵੀ ਬਹੁਤ ਹੀ ਵਧੀਆ ਹੈ ਅਤੇ ਬਾਰਾਦਰੀ ਗਾਰਡਨ ਵੀ ਬਾਰਾਦਰੀ ਗਾਰਡਨ ਵਿੱਚ ਕਾਫੀ ਤਰ੍ਹਾਂ ਦੇ ਫੁੱਲ ਬੂਟੇ ਲੱਗੇ ਹੋਏ ਹਨ ਜੋ ਕਿ ਬਹੁਤ ਹੀ ਵਧੀਆ ਹਨ ਉਹਦੇ ਵਿੱਚ ਬਾਰਾਂ ਗੇਟ ਹਨ ਅਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਮੈਂ ਆਪਣੇ ਫੇਵਰੇਟ ਰੈਸਟੋਰੈਂਟਸ 'ਚ ਵੀ ਜਾਂਦੀ ਰਹਿੰਦੀ ਹਾਂ ਜਿਵੇਂ ਕਿ ਮੈਂ ਪੀ ਵੀ ਆਰ ਵਿੱਚ ਮੈਕਡੋਨਲਸ ਜਾਂਦੀ ਰਹਿੰਦੀ ਹਾਂ ਉੱਥੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਉੱਥੇ ਮੈਂ ਕੋਲਡ ਕੋਫੀ ਅਤੇ ਬਰਗਰ ਵਗੈਰਾ ਜ਼ਿਆਦਾ ਖਾਣਾ ਪਸੰਦ ਕਰਦੀ ਹਾਂ ਪਟਿਆਲਾ ਵਿੱਚ ਸੂਟ ਜੁੱਤੀਆਂ ਵੀ ਬਹੁਤ ਸਾਰੀਆਂ ਮਿਲਦੀਆਂ ਹਨ ਜਿਵੇਂ ਕਿ ਬਾਹਰੋਂ ਵਿਦੇਸ਼ਾਂ 'ਚੋਂ ਆ ਕੇ ਲੋਕ ਸੁਹਾਗ ਗੈਲਰੀ ਤੋਂ ਸੂਟ ਵਗੈਰਾ ਜੁੱਤੀਆਂ ਖਰੀਦਦੇ ਹਨ ਜੋ ਕਿ ਪਟਿਆਲਾ ਦੇ ਬਹੁਤ ਹੀ ਸਾਰੇ ਵਧੀਆ ਲੱਗਦੇ ਹਨ ਅਤੇ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਪਟਿਆਲਾ ਬਹੁਤ ਹੀ ਵਧੀਆ ਸ਼ਹਿਰ ਹੈ